ਪੰਜ ਲੱਖ ਛੱਤੀ ਹਜ਼ਾਰ ਸੱਤ ਸੌ ਚੋਵੀ ਸੱਤ ਲੱਖ ਦੋ ਹਜ਼ਾਰ ਇੱਕ ਸੌ ਚੁਰਾਨਵੇਂ ਨੌ ਲੱਖ ਸੱਤ ਹਜ਼ਾਰ ਇੱਕ ਸੌ ਦੋ ਅੱਠ ਲੱਖ ਪੰਜ ਹਜ਼ਾਰ ਤਿੰਨ ਸੌ ਬੱਤੀ ਛੇ ਲੱਖ ਚਾਰ ਹਜ਼ਾਰ ਨੌ ਸੌ ਸੱਠ